ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਏਬੀਸੀ ਬੱਸ ਸਰਵਿਸ ਤੋਂ ਬੋਲਦੇ ਹੋ ਸਰ ਮੈਂ ਤੁਹਾਨੂੰ ਪੁੱਛਣਾ ਸੀ ਕਿ ਕਪੂਰਥਲੇ ਤੋਂ ਵੋਲਵੋ ਬੱਸ ਸਰਵਿਸ ਚੱਲਦੀ ਹੈ ਮੈਂ ਸਰ ਦਿੱਲੀ ਵਾਸਤੇ ਓਕੇ ਕਿ ਮਤਲਬ ਕਿ ਕਿੰਨੇ ਵਜੇ ਜਾਂਦੀ ਹੈ ਅਤੇ ਔਰ ਕਦੋਂ ਕਦੋਂ ਜਾਂਦੀ ਹੈ ਇਹ ਓਕੇ ਓਕੇ ਓਕੇ ਅਤੇ ਇਹ ਰੋਜ਼ ਦੀ ਬੱਸ ਸਰਵਿਸ ਹੈ ਕਿ ਕੋਈ ਕੋਈ ਦਿਨ ਹੈ ਕਿ ਜਿਹੜੇ ਇਹੀ ਚਲਦੀ ਹੈ ਓਕੇ ਓਕੇ ਅਤੇ ਇਹਦੇ ਵਿੱਚੋਂ ਟਿਕਟਾਂ ਮਿਲ ਜਾਣਗੀਆਂ ਟਿਕਟ ਅਵੇਲੇਬਲ ਹੁੰਦੀ ਹੈ ਇਹਦੇ ਵਿੱਚ

ਓਕੇ

ਠੀਕ ਹੈ ਅਤੇ ਜਿਹੜੀ ਰਾਤ ਨੂੰ ਚਲਦੀ ਹੈ ਉਹ ਨੋਰਮਲ ਹੈ ਕਿ ਸਲੀਪਰ ਬੱਸ ਹੈ ਉਹ ਓਕੇ ਅਤੇ ਟਿਕਟ ਦੇ ਚਾਰਜਸ ਕਿੰਨੇ ਆ ਜਿਹੜੀ ਸਵੇਰੇ ਚਲਦੀ ਹੈ ਉਹ ਰਾਤ ਵਾਲੀ ਦੇ ਠੀਕ ਹੈ ਅਤੇ ਇਹ ਮਤਲਬ ਕਿ ਕਟੜਾ ਵੀ ਜਾਂਦੀ ਹੈ ਤੁਹਾਡੇ ਇੱਥੋਂ ਕਪੂਰਥਲੇ ਤੋਂ ਅਤੇ ਉਹ ਸਿੱਧਾ ਹੀ ਜਾਂਦੀ ਹੈ ਕਟੜਾ ਕੇ ਵਿਚ ਸਟੋਪਿਜ ਲੈਂਦੀ ਹੈ ਓਕੇ ਠੀਕ ਹੈ ਅਤੇ ਜਿਹੜੀ ਦਿੱਲੀ ਜਾਂਦੀ ਹੈ ਉਹ ਸਵੇਰੇ ਛੇ ਵਜੇ ਚੱਲ ਕੇ ਕਿੰਨੇ ਵਜੇ ਉਤਾਰਦੀ ਹੈ ਦੁਪਹਿਰੇ ਓਕੇ ਓਕੇ ਚਲੋ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਹਾਂਜੀ ਅਤੇ ਵੈਸੇ ਤਾਂ ਤਾਂ ਮੇਨ ਤਾਂ ਦਿੱਲੀ ਕੱਟੜਾ ਬਾਰੇ ਹੀ ਪੁੱਛਣਾ ਸੀ ਜੇ ਹੋਰ ਕਿਸੇ ਦੀ ਵੀ ਹੈਗੀ ਹੈ ਤਾਂ ਉਹ ਵੀ ਦੱਸ ਦਿਓ ਅੰਮ੍ਰਿਤਸਰ ਦੀ ਹੈਗੀ ਹੈ ਓਕੇ ਰੋਜ਼ ਦੀ ਚਾਰ ਜਾਂਦੀ ਹੈ ਉਹ ਉਹਨਾਂ ਦੀ ਟਾਈਮਿੰਗ ਦੱਸੋਗੇ ਤੁਸੀਂ ਮੈਨੂੰ ਓਕੇ ਠੀਕ ਹੈ ਓਕੇ ਛੇ ਵਜੇ ਦਸ ਵਜੇ ਤਿੰਨ ਵਜੇ ਔਰ ਨੌਂ ਵਜੇ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ